ਹਾਂਜੀ ਮੈਂ ਤੁਹਾਨੂੰ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦਾ ਹਾਂ ਭੰਗੜੇ ਦੀ ਮਹੱਤਤਾ ਬਹੁਤ ਵੱਡੀ ਹੈ ਖਾਸ ਕਰ ਪੰਜਾਬ ਦੀ ਸੰਸਕ੍ਰਿਤ ਵਿਰਾਸਤ ਵਿੱਚ ਭੰਗੜਾ ਸਿਰਫ ਇੱਕ ਨਾਚ ਹੀ ਨਹੀਂ ਬਲਕਿ ਇਹ ਪੰਜਾਬੀ ਲੋਕ ਗੀਤ ਸਾਂਝੀ ਖੁਸ਼ੀ ਅਤੇ ਤਿਓਹਾਰਾਂ ਦਾ ਹਿੱਸਾ ਵੀ ਹੈ ਪਹਿਲਾ ਇਹ ਖੇਤੀਬਾੜੀ ਨਾਲ ਜੁੜਿਆ ਜਾਂਦਾ ਸੀ ਖਾਸ ਕਰ ਵਿਸਾਖੀ ਦੇ ਮੇਲੇ ਤੇ ਜਦੋਂ ਕਿਸਾਨ ਆਪਣੀ ਫ਼ਸਲ ਦੀ ਕਟਾਈ ਵਿੱਚ ਖੁਸ਼ੀ ਵਿੱਚ ਭੰਗੜਾ ਪਾਉਂਦੇ ਸਨ ਇਹ ਨਾਚ ਸ਼ਕਤੀ ਉਤਸ਼ਾਹ ਅਤੇ ਜੋਸ਼ ਦਾ ਪ੍ਰਤੀਕ ਹੈ ਅੱਜ ਦੇ ਸਮੇਂ ਵਿੱਚ ਭੰਗੜਾ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਬਲ ਕੀ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਚੁੱਕਾ ਹੈ ਕਨੇਡਾ ਯੂ ਕੇ ਯੂ ਐੱਸ ਏ ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਵਿੱਚ ਪੰਜਾਬੀ ਕਮਿਊਨਿਟੀ ਇਸ ਨੂੰ ਆਪਣੀ ਪਹਿਚਾਣ ਬਣਾ ਕੇ ਮਨਾ ਰਹੇ ਹਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਭੰਗੜਾ ਮੁਕਾਬਲੇ ਹੁੰਦੇ ਹਨ ਜਿੱਥੇ ਦੁਨੀਆਂ ਭਰ ਤੋਂ ਟੀਮਾਂ ਆ ਕੇ ਹਿੱਸਾ ਲੈਂਦੀਆਂ ਹਨ ਇਸ ਤਰ੍ਹਾਂ ਭੰਗੜਾ ਸਿਰਫ਼ ਪੰਜਾਬ ਤੱਕ ਨਹੀਂ ਬਲਕੀ ਪੂਰੀ ਦੁਨੀਆਂ ਵਿੱਚ ਪੰਜਾਬੀ ਸੰਸਕ੍ਰਿਤ ਦੀ ਇੱਕ ਸ਼ਾਨ ਬਣ ਚੁੱਕਾ ਹੈ ਧੰਨਵਾਦ ਜੀ